ਇੱਕ ਜਨਵਰੀ ਉੱਨੀ ਸੌ ਚੁਰਾਨਵੇਂ ਦੋ ਫਰਵਰੀ ਉੱਨੀ ਸੌ ਤ੍ਰਿਆਨਵੇਂ ਤਿੰਨ ਮਾਰਚ ਉੱਨੀ ਸੋ ਚੁਰਾਨਵੇਂ ਚਾਰ ਅਪ੍ਰੈਲ ਉੱਨੀ ਸੌ ਪਚਾਨਵੇਂ ਛੇ ਮਾਰਚ ਉੱਨੀ ਸੌ ਛਿਆਨਵੇਂ